ਹੈਲੋ ਸਤ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਸਿੰਘ ਬੋਲ ਰਿਹਾ ਜੀ ਤੁਸੀਂ ਸੈਨਿਕ ਟੇਲਰ ਤੋਂ ਬੋਲ ਰਹੇ ਜੀ ਮੈਂ ਤੁਹਾਨੂੰ ਮੈਂ ਥੋਨੂੰ ਦੋ ਹਫ ਦੋ ਹਫਤਿਆਂ ਦਾ ਵਸਤੇ ਉਹ ਸੂਟ ਦਿੱਤਾ ਸੀ ਪੈਂਟ ਕੋਟ ਦਿੱਤਾ ਸੀਗਾ ਸੁਆਣੇ ਵਾਸਤੇ ਜੀ ਤੁਸੀਂ ਉਹ ਸਿਉਂਤਾ ਜੀ

ਮੈ ਮੈਨੂੰ ਵਿਆਹ 'ਚ ਜਾਣ ਵਾਸਤੇ ਉਹ ਜਲਦੀ ਚਾਹੀਦਾ ਜੀ ਉਹ ਪੈਂਟ ਕੋਟ ਮੈਨੂੰ ਉਹ ਦੋ ਤਿੰਨ ਦਿਨ 'ਚ ਕਰਦੂੰਗੇ ਜੀ ਠੀਕ ਹੈ ਹੈ ਤਾਂ ਤੁਹਾਨੂੰ ਖੇਚਲ ਹੈ ਜੀ ਪਰ ਜੇ ਤੁਸੀਂ ਕਰ ਸਕਦੇ ਹੋ ਤਾਂ ਵਧੀਆ ਰਹੂੰਗਾ ਜੀ ਠੀਕ ਹੈ ਭਾਅ ਜੀ ਫਿਰ ਠੀਕ ਹੈ ਤੁਸੀਂ ਮੈਨੂੰ ਫੋਨ ਕਰ ਦਿਓ ਜਦ ਸਿਉਂਤੇ ਓਕੇ ਜੀ ਓਕੇ